ਯੂਟੀਊਬ 'ਤੇ ਜਿਹੜਾ ਮੇਰਾ ਪਸੰਦੀਦਾ ਜਿਹੜਾ ਚੈਨਲ ਹੈ ਉਹ ਹੈ ਕੁਕ ਵਿਦ ਰੀਚਾ ਉਹ ਬਹੁਤ ਹੀ ਵਧੀਆ ਪਕਵਾਨ ਬਣਾਉਂਦੇ ਹਨ ਜਿਵੇਂ ਕਿ ਹੁਣੇ ਉਹਨਾਂ ਨੇ ਇੱਕ ਨਵੇਂ ਤਰੀਕੇ ਦੀ ਲੱਸੀ ਬਣਾਉਣੀ ਵੀ ਸਿਖਾਈ ਸੀ ਜਿਹੜੀ ਕਿ ਗਰਮੀਆਂ ਦੇ ਟਾਈਮ ਤੇ ਬਹੁਤ ਹੀ ਠੰਡੀ ਹੁੰਦੀ ਹੈ ਅਤੇ ਸਾਨੂੰ ਬਹੁਤ ਹੀ ਉਹ ਫਾਇਦੇਮੰਦ ਹੁੰਦੀ ਹੈ ਅਤੇ ਹਾਲ ਹੀ 'ਚ ਮੈਂ ਆਪੇ ਬਣਾਉਣਾ ਸਿੱਖਿਆ ਸੀ ਆਪੇ ਉਹਨਾਂ ਨੇ ਪਤਾ ਕਿਸ ਤਰੀਕੇ ਨਾਲ ਬਣਾਇਆ ਜਿਵੇਂ ਕਿ ਪਹਿਲਾਂ ਉਹਨਾਂ ਨੇ ਸੂਜੀ ਲਿਤੀ ਸੂਜੀ ਦੇ ਅੰਦਰ ਥੋੜਾ ਜਿਹਾ ਆਟਾ ਬਣਾ ਪਾਇਆ ਅਤੇ ਫੇਰ ਕੀ ਕੀਤਾ ਉਹਨਾਂ ਨੇ ਸ਼ਿਮਲਾ ਮਿਰਚ ਪਨੀਰ ਇਸ ਤਰੀਕੇ ਦੀ ਜਿਹੜੀ ਸਬਜ਼ੀਆਂ ਸੀ ਉਹਨੂੰ ਕੱਟ ਕੱਟ ਕੇ ਉਹਦੇ ਅੰਦਰ ਛੋਟੇ ਛੋਟੇ ਉਹਦੇ ਟਮਾਟਰ ਪਿਆਜ਼ ਦੇ ਪੀਸ ਪਾ ਕੇ ਹੈ ਨਾ ਮਿਰਚ ਮਸਾਲਾ ਪਾ ਕੇ ਤਾਂ ਕਿ ਇੱਕ ਵਧੀਆ ਮਸਾਲਾ ਤਿਆਰ ਕੀਤਾ ਅਤੇ ਜਦੋਂ ਮਸਾਲਾ ਤਿਆਰ ਹੋ ਗਿਆ ਤਾਂ ਇੱਕ ਸਪੈਸ਼ਲ ਤਰੀਕੇ ਦਾ ਢਾਂਚਾ ਆਉਂਦਾ ਹੈ ਜਿਹਦੇ ਅੰਦਰ ਉਹ ਮਸਾਲਾ ਪਾ ਦਿੱਤਾ ਜਾਂਦਾ ਹੈ ਅਤੇ ਜਦ ਆਪਾਂ ਉਹਨੂੰ ਗੈਸ ਕੁਕਿੰਗ ਦੇ ਉੱਪਰ ਉਹਨੂੰ ਗਰਮ ਕਰਦੇ ਹਾਂ ਤਾਂ ਉਹ ਕੀ ਹੁੰਦਾ ਉਹ ਪੱਕਣਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ ਅਤੇ ਜਦ ਉਹ ਪੱਕਦਾ ਹੈ ਤਾਂ ਉਹਨੂੰ ਆਪਾਂ ਹੌਲੀ ਹੌਲੀ ਖਾ ਸਕਦੇ ਹਾਂ ਅਤੇ ਇਸ ਤੋਂ ਇਲਾਵਾ ਆਪਾਂ ਉਹਦੇ ਨਾਲ ਇੱਕ ਚੱਟਨੀ ਵੀ ਬਣਾਇਆ ਬਣਾ ਸਕਦੇ ਹਾਂ ਜਿਹੜੀ ਕਿ ਮੈਂ ਉਹਨਾਂ ਤੋਂ ਸਿੱਖੀ ਸੀ ਆਪਾਂ ਟਮਾਟਰ ਨੂੰ ਪੀਸ ਕੇ ਅਤੇ ਨਾਰੀਅਲ ਨੂੰ ਪੀਸ ਕੇ ਉਹਦੀ ਚੱਟਣੀ ਬਣਾ ਸਕਦੇ ਹਾਂ ਜਿਹੜਾ ਉਸ ਪਰਟੀਕੁਲਰ ਆਟੇ ਨਾਲ ਖਾਣ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦਾ ਹੈ